ਹਰ ਪੰਛੀ ਦੀ ਆਪਣੀ ਵਿਲੱਖਣ ਆਵਾਜ਼ ਹੁੰਦੀ ਹੈ ਉਸ ਦੀ ਪ੍ਰਜਾਤੀ ਵਾਤਾਵਰਨ ਅਨੁਸਾਰ ਵੱਖ ਵੱਖ ਹੋ ਸਕਦੀ ਹੈ ਕੁਝ ਪੰਛੀ ਪ੍ਰਮੁੱਖ ਪੰਛੀਆਂ ਦੀਆਂ ਆਵਾਜ਼ਾਂ ਹੇਠ ਇੱਦਾਂ ਦੀਆਂ ਭਾਸ਼ਾ ਹੁੰਦੀਆਂ ਨੇ ਕੋਲ ਇੱਕ ਇਸ ਤਰ੍ਹਾਂ ਪੰਛੀ ਹੈ ਜਿਹਦੀ ਆਵਾਜ਼ ਮਿੱਠੀ ਬਹੁਤ ਹੁੰਦੀ ਹੈ ਅਤੇ ਕੂੰ ਕੂੰ ਦੀ ਆਵਾਜ਼ ਕਰਦੀ ਹੈ ਪਪੀਹੇ ਦੀ ਆਵਾਜ਼ ਵੀ ਬਹੁਤ ਹੀ ਪਿਆਰੀ ਹੁੰਦੀ ਹੈ ਮਿੱਠੀ ਅਵਾਜ਼ ਹੁੰਦੀ ਹੈ ਅਤੇ ਪਪੀਹਾ ਉਸ ਤੋਂ ਬਾਅਦ ਬੁਲਬੁਲ ਦੀ ਪੰਛੀ ਦੀ ਆਵਾਜ਼ ਵੀ ਬਹੁਤ ਹੀ ਸੁਰੀਲੀ ਅਤੇ ਮਿੱਠੀ ਹੁੰਦੀ ਹੈ ਅਤੇ ਉਹਦੀ ਪਹਿਚਾਣ ਹੁੰਦੀ ਹੈ ਜੋ ਬੁਲਬੁਲ ਸਵੇਰ ਅਤੇ ਸ਼ਾਮ ਦੇ ਟਾਈਮ ਇਹ ਬ ਬੋਲਦੀ ਹੈ ਅਤੇ ਮੋਰ ਦੀ ਮੋਰ ਇੱਕ ਪੰਛੀ ਹੈ ਮੋਰ ਦੀ ਵੀ ਆਵਾਜ਼ ਵੀ ਬਹੁਤ ਹੀ ਵਧੀਆ ਹੁੰਦੀ ਹੈ ਮੋਰ ਦੀ ਆਵਾਜ਼ ਸਵੇਰੇ ਅਤੇ ਸ਼ਾਮ ਨੂੰ ਹੁੰਦੀ ਹੈ ਮੋਰ ਮੌਸਮ ਬਦਲਣ ਦੇ ਜਾਂ ਮੌਸਮ ਬਦਲਣ ਵਿੱਚ ਜਾਂ ਬਰਖਾ ਦੇ ਸਮੇਂ ਮੋਰ ਜ਼ਿਆਦਾ ਜਾਨੀ ਕਿ ਬੋਲਦਾ ਹੈ ਉਹਦੀ ਅਵਾਜ਼ ਬਹੁਤ ਅੱਛੀ ਹੁੰਦੀ ਹੈ ਉਹਦੇ ਵਿੱਚੋਂ ਕਾਂ ਦੀ ਆਵਾਜ਼ ਬਹੁਤ ਹੀ ਵਧੀਆ ਕਾਂ ਦੀ ਆਵਾਜ਼ ਵਧੀਆ ਹੁੰਦੀ ਹੈ ਕਾਂ ਦੀ ਇਹ ਇਹਦੇ ਵਿੱਚੋਂ ਇੱਕ ਆਪਣੀ ਚਿੜੀਆਂ ਦੀ ਆਵਾਜ਼ ਵੀ ਬਹੁਤ ਹੀ ਵਧੀਆ ਹੁੰਦੀ ਹੈ ਚਿੜੀਆਂ ਚੀਂ ਚੀਂ ਦੀ ਆਵਾਜ਼ ਕਰਦੀਆਂ ਹਨ ਕੋਇਲ ਦੀ ਆਵਾਜ਼ ਕੂ ਕੂ ਦੀ ਹੁੰਦੀ ਹੈ ਅਤੇ ਸਾਰੇ ਪੰਛੀਆਂ ਦੀ ਆਵਾਜ਼ ਬਹੁਤ ਉਹਨਾਂ ਦੇ ਵਿੱਚੋਂ ਕੋਇਲ ਦੀ ਆਵਾਜ਼ ਹੀ ਬਹੁਤ ਹੀ ਸੁਰੀਲੀ ਅਤੇ ਵਧੀਆ ਹੁੰਦੀ ਹੈ ਕੋਇਲ ਦੀ ਆਵਾਜ਼ ਅਸੀਂ ਬਹੁਤ ਹੀ ਵਧੀਆ ਸੁਣਨ ਨੂੰ ਮਿਲਦੀ ਹੈ ਅਤੇ ਕੋਇਲ ਪਪੀਹੇ ਦੀ ਆਵਾਜ਼ ਵੀ ਬਹੁਤ ਹੀ ਵਧੀਆ ਹੁੰਦੀ ਹੈ ਪਪੀਹਾ ਜਦੋਂ ਬੋਲਦਾ ਹੈ ਅਤੇ ਉਹ ਮ ਮੀਂਹ ਪੈਣ ਦੇ ਟਾਈਮ ਪਬੀਹਾ ਬੋਲਦਾ ਹੈ ਉਹ ਆਪਣੀ ਖੁਸ਼ੀ ਜਾਹਿਰ ਕਰਦਾ ਹੈ ਪਪੀਹੇ ਦੀ ਆਵਾਜ਼ ਵੀ ਬਹੁਤ ਹੀ ਮਿੱਠੀ ਅਤੇ ਪਿਆਰੀ ਹੁੰਦੀ ਹੈ